ਰੂਪਨਗਰ ਜ਼ਿਲ੍ਹੇ ਵਿੱਚ ਕਈ ਮਹੱਤਵ ਸਥਾਨ ਹਨ ਜਿਵੇਂ ਕਿ ਇਸ ਦੇ ਨਾਲ਼ ਇੱਕ ਸ਼ਹਿਰ ਜਗ੍ਹਾ ਪੈਂਦੀ ਹੈ ਅਨੰਦਪੁਰ ਸਾਹਿਬ ਉੱਥੇ ਜਿਹੜਾ ਗੁਰਦੁਆਰਾ ਹੈ ਬਹੁਤ ਜ਼ਿਆਦਾ ਵਧੀਆ ਹੈ ਉੱਥੇ ਲੋਕ ਅਰਾਮ ਨਾਲ ਜਾ ਸਕਦੇ ਹਨ ਕਿਸੀ ਗੁਰਦੁਆਰੇ ਜਿਵੇਂ ਕਿ ਰੋਪੜ ਵਿੱਚ ਕਿਤੇ ਵੀ ਜਗ੍ਹਾ ਮੰਨ ਲਉ ਕੋਈ ਵੀ ਧਰਮ ਦਾ ਬੰਦਾ ਜਦ ਮਰਜ਼ੀ ਆ ਸਕਦਾ ਹੈ ਜਾਂ ਮੰਦਰ ਹੈ ਜਾਂ ਗੁਰਦੁਆਰੇ ਹਨ ਅਨੰਦਪੁਰ ਸਾਹਿਬ ਵਿੱਚ ਵਿਰਾਸਤ ਏ ਖਾਲਸਾ ਹੈ ਇੱਕ ਜਿਹਨੂੰ ਅੱਠਵਾਂ ਅਜੂਬਾ ਵੀ ਕਹਿੰਦੇ ਹਨ ਦੁਨੀਆਂ ਦਾ ਉਹ ਬਣਿਆ ਹੋਇਆ ਹੈ ਜਿੱਥੇ ਸਾਨੂੰ ਜਾ ਕੇ ਸਿੱਖਾਂ ਦੇ ਜਿਹੜੇ ਹੈ ਜੋ ਵੀ ਬਲੀਦਾਨ ਵਗੈਰਾ ਹੋਏ ਸੀ ਉਹਦੇ ਬਾਰੇ ਸਾਨੂੰ ਪਤਾ ਲੱਗਦਾ ਹੈ ਪੂਰਾ ਉਹਦੇ 'ਚ ਪ੍ਰੋਜੈਕਟ ਦੇ ਥਰੂ ਇੱਕ ਫਿਲਮ ਚੱਲਦੀ ਹੈ ਜਿਹਨੂੰ ਦੇਖਦੇ ਹਾਂ ਉੱਥੇ ਬਾਬਾ ਜੀ ਦਾ ਸਟੈਚੂ ਮੂਰਤੀ ਲਾਈ ਹੋਈ ਹੈ ਜਿਹੜੀ ਕਿਆ ਕਹਿੰਦੇ ਹੈ ਸਾਨੂੰ ਬੋਲ ਕੇ ਦੱਸਦੀ ਹੈ ਜਿਹਨੂੰ ਦੇਖਣ ਐਂ ਲੱਗਦਾ ਹੈ ਵੀ ਬਿਲਕੁਲ ਰਿਅਲ ਬੰਦਾ ਬੋਲ ਰਿਹਾ ਹੈ ਪਰ ਉਹ ਇੱਕ ਤਰੀਕੇ ਦਾ ਸਟੈਚੂ ਹੈ ਉਸ ਤਰੀਕੇ ਨਾਲ਼ ਰੋਪੜ ਦੇ ਵਿੱਚ ਖਾਸ ਇੱਕ ਗੁਰਦੁਆਰਾ ਹੈ ਜਿਸਨੂੰ ਟਿੱਬੀ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹ ਗੁਰਦੁਆਰਾ ਬਹੁਤ ਬੜਾ ਹੈ ਸਤਲੁਜ ਦਰਿਆ ਦੇ ਕੰਢੇ 'ਤੇ ਸਥਿਤ ਹੈ ਜਿੱਥੇ ਦਾ ਵਿਊ ਬਹੁਤ ਵਧੀਆ ਹੈ ਲੋਕ ਦੂਰ ਦੂਰ ਤੋਂ ਆਉਂਦੇ ਹਨ ਇੱਥੇ ਰਹਿਣ ਸਹਿਣ ਦੀ ਸੁਵਿਧਾ ਵਿੱਚ ਹੀ ਹੈ ਚੌਵੀ ਘੰਟੇ ਲੰਗਰ ਚਲਦਾ ਰਹਿੰਦਾ ਹੈ ਸ਼ਾਮ ਵਿੱਚ ਗੱਲ ਜੋ ਉੱਧਰ ਮੰਦਿਰਾਂ ਦੀ ਗੱਲ ਕਰਾਂ ਤਾਂ ਮੰਦਰ ਹੀ ਬਹੁਤ ਸਾਰੇ ਹਨ ਰੋਪੜ ਦੇ ਵਿੱਚ ਉਸ ਤੋਂ ਬਾਅਦ ਦੀ ਗੱਲ ਕਰਾਂ ਅਤੇ ਲੋਕ ਜ਼ਿਆਦਾਤਰ ਆਪਣਾ ਸਮਾਂ ਰੋਪੜ ਦੇ ਇੱਕ ਹੈੱਡ 'ਤੇ ਜੋ ਕਿ ਹੈੱਡ ਸਤਲੁਜ ਦਰਿਆ 'ਤੇ ਇੱਕ ਨਹਿਰ ਦਾ ਕੰਢਾ ਬਣਾਇਆ ਹੋਇਆ ਹੈ ਇੱਕ ਦਰਿਆ ਦਾ ਉੱਥੇ ਬਤੀਤ ਕਰਦੇ ਹਨ ਉੱਥੇ ਲੈਟਾ ਲੂਟਾਂ ਐਨੀ ਵਧੀਆ ਲੱਗੀਆਂ ਹੋਈਆਂ ਹਨ ਰਾਤ ਦਾ ਜੋ ਹੈ ਉਹ ਸਿਸਟਮ ਬਹੁਤ ਵਧੀਆ ਲੱਗਦਾ ਹੈ ਉੱਥੇ ਮਿਊਜਿਕ ਵਗੈਰਾ ਚਲਦਾ ਰਹਿੰਦਾ ਹੈ ਉੱਥੇ ਜਾ ਕੇ ਪੂਰੀ ਐਨ ਤਾਜ਼ੀ ਹਵਾ ਖਾ ਬੰਦੇ ਖਾਂਦੇ ਹਨ ਸਵੇਰ ਦੀ ਸੈਰ ਕਰਨ ਜਾਵੇ ਤਾਂ ਬੰਦਾ ਉੱਥੇ ਐਨ ਤਾਜ਼ੀ ਹਵਾ ਮਿਲਦੀ ਹੈ ਅਤੇ ਬਜ਼ੁਰਗ ਲੋਕ ਉੱਥੇ ਜਾ ਕੇ ਸਵੇਰੇ ਯੋਗਾ ਵਗੈਰਾ ਵੀ ਕਰਦੇ ਹਨ